ਪਾਣੀ ਨੂੰ ਫਿਲਟਰ ਕਰਨ ਲਈ ਅਤੇ ਸ਼ੁੱਧ ਕਰਨ ਲਈ ਤੁਸੀਂ ਕਿਹੜੇ ਅਭਿਆਸਾਂ ਦਾ ਪਾਲਣਾ ਕਰਦੇ ਹੋ ਅਤੇ ਅਸੀਂ ਪਹਿਲਾਂ ਦੋ ਘੜੇ ਦਾ ਘੜੇ ਦਾ ਪਾਣੀ ਪੀਂਦੇ ਹੁੰਦੇ ਤੇ ਅਤੇ ਸ਼ੁੱਧ ਹੁੰਦਾ ਸੀ ਅੱਜ ਕੱਲ ਫਿਲਟਰ ਬ ਹੋ ਗਏ ਅਤੇ ਫਿਲਟਰ ਦਾ ਬਹੁਤ ਵ ਵਧ ਵਧੀਆ ਨਹੀਂ ਸਭ ਤੱਤ ਮਰੇ ਪਏ ਹੁੰਦੇ ਫਿਲਟਰ ਪਾਣੀ ਦੇ ਅਤੇ ਨਲ ਨਲਕੇ ਹੁੰਦੇ ਸੀ ਸੌ ਫੁਟ ਅਤੇ ਪੰਜਾਹ ਫੁੱਟ 'ਤੇ ਪਾਣੀ ਇਹ ਨਿਕਲ ਆਉਂਦਾ ਸੀ ਅਤੇ ਉਸ ਦਾ ਪਾਣੀ ਵੀ ਬਹੁਤ ਪੀਣ ਨੂੰ ਸਵਾਦ ਲੱਗਦਾ ਅਤੇ ਅਤੇ ਵਧੀਆ ਟੇਸਟੀ ਹੁੰਦਾ ਸੀ ਅਤੇ ਫਿਲਟਰ ਦਾ ਕੰਮ ਤਾਂ ਹੁਣ ਇਹ ਪੀ ਲਉ ਅਤੇ ਪਿਆਸ ਹੀ ਨਹੀਂ ਬੁਝਦੀ ਇਹਦੇ ਗੈਲ ਤਾਂ ਠੀਕ ਆ ਜੀ ਅਤੇ ਆਪਣਾ ਉਹ ਫਿਲਟਰ ਅਤੇ ਖੂਹ ਹੁੰਦੇ ਸੀ ਖੂਹਾਂ ਦਾ ਮੋਟਰਾਂ ਦਾ ਪਾਣੀ ਵੀ ਬਹੁਤ ਵਧੀਆ ਹੁੰਦਾ ਤਾ ਅਤੇ ਫਿਲਟਰ ਤਾਂ ਲੋਕ ਐਵੇਂ ਬੱਸ ਇੱਕ ਦੂਜੇ ਦੇ ਲੱਗੇ ਲੱਗੀ ਅਤੇ ਭੇਡ ਚਾਲ ਪਿੱਛੇ ਅਤੇ ਆਪਣਾ ਫਿਲਟਰ ਲਾਉਣ ਲੱਗ ਗਏ ਫਿਲਟਰ ਜੇਕਰ ਉਹ ਕੁਆਲਟੀ ਨਹੀਂ ਹੈਗੀ ਜੋ ਇੱਕ ਦੂਸ ਸ਼ੁੱਧ ਪਾਣੀ ਵਿੱਚ ਹੈਗੀ ਸੀ ਅਤੇ ਸਿੱਧਾ ਡਰੈਕਟ ਆਉਂਦਾ ਤਾ ਇਹ ਅਤੇ ਪਾਣੀ ਵਧੀਆ ਪੀਣ ਨੂੰ ਸਵਾਦ ਲੱਗਦਾ ਸੀ ਅਤੇ ਠੀਕ ਲੱਗਦਾ ਸੀ ਅਤੇ ਘੜਿਆਂ ਦੇ ਵਿੱਚ ਰੱਖ ਕੇ ਲੋਕ ਪੀਂਦੇ ਸੀ ਪਹਿਲਾਂ ਉਹ ਘੜਿਆਂ ਦਾ ਪਾਣੀ ਵੀ ਬਹੁਤ ਸਵਾਦ ਲੱਗਦਾ ਹੁੰਦਾ ਸੀ ਅਤੇ ਫਿਲਟਰ ਵਿੱਚ ਤਾਂ ਕ ਕਿਤੇ ਸਾਫ ਸਫਾਈ ਏ ਨਹੀਂ ਹੁੰਦੀ ਕਿਤੇ ਕਿਵੇਂ ਪਾਣੀ ਪੀਣ ਨੂੰ ਸਵਾਦ ਨਹੀਂ ਹੁੰਦਾ ਯਾਨੀ ਕਹਿਣ ਦਾ ਮਤਲਬ ਅਤੇ ਟੇਸਟ ਨਹੀਂ ਹੈਗੇ ਇਹਦਾ ਫਿਲਟਰ ਪਾਣੀ ਦਾ ਅਤੇ ਉਹਦਾ ਪਾਣੀ ਹੁੰਦਾ ਗਾ ਮੋਟਰਾਂ ਦਾ ਹੁੰਦਾ ਤਾਂ ਸੂਏ ਸੂਇਆਂ ਦਾ ਸੂਏ ਹੁੰਦੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਨਹਿਰ ਨਹਿਰਾਂ ਕਹਿ ਦਿੰਦੇ ਹਾਂ ਅਤੇ ਉਹ ਵੀ ਪਾਣੀ ਇਹ ਪਹਾੜਾਂ ਤੋਂ ਆਉਂਦਾ ਲੱਗ ਕੇ ਉਹ ਵੀ ਬਹੁਤ ਵਧੀਆ ਪਾਣੀ ਠੀਕ ਪੀਣ ਨੂੰ ਵਧੀਆ ਮਿਲਦਾ ਹੈ